ਇੱਥੇ ਕੁਝ ਤਰੀਕੇ ਹਨ ਜਿਹਨਾਂ ਨਾਲ ਪੰਜਾਬ ਵਿੱਚ ਨਿਊਜ਼ ਮੀਡੀਆ ਵਿਗਿਆਨ ਅਤੇ ਤਕਨੋਲਜੀ ਨਾਲ ਸੰਬੰਧਿਤ ਮੁੱਦਿਆਂ ਨੂੰ ਕਵਰ ਕਰਦਾ ਹੈ ਵੱਧਦੀ ਗਿਣਤੀ ਵਿੱਚ ਬਲੋਗਾਂ ਦੀ ਸਕੈਨਿੰਗ ਮੀਡੀਆ ਹੋਣ ਵਿਗਿਆਨਕ ਅਤੇ ਟੈਕਨਾਲਜੀ ਦਾ ਸਬੰਧ ਨਵੀਨਤਨ ਕਰਨ ਨਾਲ ਅਤੇ ਰੋਜ਼ਾਨਾ ਨੂੰ ਲੱਭਣ ਲਈ ਬਲੋਗਾਂ ਅਤੇ ਹੋਰ ਆਨਲਾਈਨ ਸਰੋਤਾਂ ਨੂੰ ਵਧੇਰੇ ਧਿਆਨ ਨਾਲ ਦੇਖ ਰਿਹਾ ਹੈ ਮੀਡੀਆ ਵਿਗਿਆਨੀਆਂ ਨੂੰ ਸੰਦਾਂ ਨਾਲ ਸ਼ਕਤੀ ਪ੍ਰਦਾਨ ਕਰਦਾ ਹੈ ਮੀਡੀਆ ਵਿਗਿਆਨੀਆਂ ਨੂੰ ਉਹਨਾਂ ਦੇ ਖੋਜ ਨੂੰ ਜਨਤਕ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ ਜਿਸ ਨਾਲ ਲੋਕਾਂ ਨੂੰ ਵਿਗਿਆਨ ਅਤੇ ਤਕਨੋਲੋਜੀ ਬਾਰੇ ਜਾਣਕਾਰੀ ਮਿਲਦੀ ਹੈ ਵਿਗਿਆਨਕ ਅਸਫਲਤਾਵਾਂ ਬਾਰੇ ਰਿਪੋਰਟਾਂ ਮ ਮੀਡੀਆ ਵਿਗਿਆਨਿਕ ਅਸਫਲਤਾਵਾਂ ਬਾਰੇ ਵੀ ਰਿਪੋਰਟ ਕਰਦਾ ਹੈ ਜੋ ਲੋਕਾਂ ਦਾ ਵਿਗਿਆਨਕ ਖੋਜ ਲਈ ਸਵੀਨ ਸਮੀਨਾਵਾਂ ਅਤੇ ਸਮਝਣ ਵਿੱਚ ਮਦਦ ਕਰਦਾ ਹੈ